ਦੇਖੋ ਖਾਣਾ ਬਣਾਉਣ ਤੋਂ ਪਹਿਲਾਂ ਮੈਂ ਕੁਝ ਚੀਜ਼ਾਂ ਦਾ ਧਿਆਨ ਰੱਖਦਾ ਹਾਂ ਜਿਵੇਂ ਕਿ ਜਿਹੜੀ ਕੜਾਹੀ 'ਚ ਖਾਣਾ ਬਣਾਉਣਾ ਕਿ ਉਹ ਧੋਤੀ ਹੋਈ ਹੈ ਕਿ ਨਹੀਂ ਨਹੀਂ ਮੈਂ ਉਹਨੂੰ ਸਾਫ ਕਰ ਲੈਂਦਾ ਪਹਿਲਾਂ ਅਤੇ ਬਣਾਉਣਾ ਕੀ ਹੈ ਜਿਵੇਂ ਜੇਕਰ ਆਲੂ ਬਣਾਉਣੇ ਨੇ ਤਾਂ ਪਹਿਲਾਂ ਮੈਂ ਆਲੂਆਂ ਨੂੰ ਛਿੱਲ ਲੈਂਦਾ ਫਿਰ ਮਸਾਲੇ ਮਸੂਲੇ ਜੇ ਮੈਂ ਸਾਰੇ ਇੱਕ ਜਗ੍ਹਾ 'ਤੇ ਕਰ ਲੈਂਦਾ ਜਿਵੇਂ ਹਲਦੀ ਹੋ ਗਈ ਜੀਰਾ ਹੋ ਗਿਆ ਤੇਲ ਹੋ ਗਿਆ ਅਤੇ ਫਿਰ ਕਈ ਵਾਰੀ ਜੇ ਮੈਨੂੰ ਸਮਝ ਨਹੀਂ ਆਉਂਦੀ ਕਿਵੇਂ ਬਣਾਉਣਾ ਕੀ ਹੈ ਫਿਰ ਮੈਂ ਯੂਟੀਊਬ ਤੋਂ ਵੀ ਵੀਡੀਓ ਦੇਖ ਲੈਂਦਾ ਹੁੰਦਾ ਅਤੇ ਮੈਂ ਸਾਰੀ ਜਿਹੜੀ ਸਮੱਗਰੀ ਹੈ ਜਿਹੜੀ ਬਣਾਉਣ ਲਈ ਵਰਤਣੀ ਹੈ ਪਿਆਜ ਟਮਾਟਰ ਉਹਨਾਂ ਸਾਰਿਆਂ ਨੂੰ ਕੱਟ ਕੇ ਰੱਖ ਲੈਂਦਾ ਅਤੇ ਇੱਕ ਇੱਕ ਵਾਰੀ ਲਾਈਨ 'ਚ ਲਾ ਲੈਂਦਾ ਤਾਂ ਕਿ ਜਦੋਂ ਮੈਂ ਬਣਾ ਰਿਹਾ ਹੋਵਾਂ ਤਾਂ ਮੈਨੂੰ ਸੌਖਾ ਹੋਵੇ ਫਿਰ ਮੈਂ ਸਾਰਾ ਕੁਛ ਜਿਵੇਂ ਜੇਕਰ ਮੈਂ ਕੁਛ ਬਣਾ ਰਿਹਾ ਹਾਂ ਆਲੂ ਬਣਾ ਰਿਹਾ ਹਾਂ ਤਾਂ ਮੈਂ ਪਹਿਲਾਂ ਤੇਲ ਪਾਨਾ ਕੜਾਹੀ 'ਚ ਫਿਰ ਮੈਂ ਉਹ 'ਚ ਜੀਰਾ ਪਾ ਕੇ ਬਾਕੀ ਸਾਰਾ ਮਸਾਲੇ ਮਸੂਲੇ ਪਾ ਕੇ ਫਿਰ ਮੈਂ ਨਾਲ ਨਾਲ ਨਾਲ ਹੀ ਜਿੰਨਾਂ ਦੇਰ ਉਹ ਗੈਸ 'ਤੇ ਪਿਆ ਹੁੰਦਾ ਮੈਂ ਸਬਜ਼ੀਆਂ ਕੱਟ ਲੈਂਦਾ ਅਤੇ ਸਾਰਿਆਂ ਨੂੰ ਗੈਸ 'ਤੇ ਚੜ੍ਹਾ ਦਿੰਦਾ ਹੁੰਦਾ ਫਿਰ ਉਹ ਤੋਂ ਬਾਅਦ ਸਾਫ ਸਫਾਈ ਵੀ ਜ਼ਰੂਰੀ ਹੈ ਫਿਰ ਜਿੰਨੀ ਦੇਰ ਉਹ ਬਣ ਰਹੀ ਹੁੰਦੀ ਹੈ ਮੈਂ ਰਸੋਈ ਦੀ ਨਾਲ ਨਾਲ ਸਾਫ ਸਫਾਈ ਵੀ ਕਰ ਦਿੰਦਾ